ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਮੈਮ ਮੈਂ ਅਨੂ ਸ਼ਰਮਾ ਬੋਲ ਰਹੇ ਹਾਂ

ਓਕੇ ਓਕੇ

ਓਕੇ ਮੈਮ ਠੀਕ ਹੈ ਮੈਮ ਮੈਮ ਤੁਸੀਂ ਕਿਸ ਰਿਗਾਰਡਿੰਗ ਮਤਲਬ ਕਿ ਕਿਹੜੀ ਇਹਦੇ ਵਿੱਚ ਲੈਣਾ ਚਾਹੁੰਦੇ ਹੋ ਬੋਰਡ ਦੇ ਵਿੱਚ ਸੀ ਬੀ ਐੱਸ ਈ ਬੋਰਡ ਦੇ ਵਿੱਚ ਜਾਂ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਬੋਰਡ ਦੇ ਵਿੱਚ ਓਕੇ ਮੈਮ ਸੀ ਬੀ ਐੱਸ ਈ ਦੇ ਰਿਗਾਰਡਿੰਗ ਸਾਡੇ ਕੋਲ ਇੱਥੇ ਆਪਣੇ ਜਿਹੜਾ ਸਭ ਤੋਂ ਬੈਸਟ ਸਕੂਲ ਹੈਗਾ ਕੇ ਸੀ ਪਬਲਿਕ ਸਕੂਲ ਨਵਾਂਸ਼ਹਿਰ ਆ ਇਸ ਤੋਂ ਇਲਾਵਾ ਸਾਡੇ ਕੋਲ ਕੈਮਬ੍ਰੇਜ਼ ਸਕੂਲ ਹੈ ਸੈਂਟ ਜੌਸਫ ਸਕੂਲ ਹੈ ਔਰ ਜੋ ਕਿ ਕਾਫੀ ਵਧੀਆ ਪੜ੍ਹਾਇਆ ਵੀ ਜਾਂਦਾ ਹੈ ਬਟ ਕੇ ਸੀ ਸਕੂਲ ਮੇਰੇ ਖੁਦ ਦੇ ਬੱਚੇ ਵੀ ਪੜ੍ਹਦੇ ਆ ਤਾਂ ਮੇਰਾ ਖੁਦ ਦਾ ਬਹੁਤ ਅੱਛਾ ਐਕਸਪੀਰੀਅੰਸ ਹੈ ਇੱਥੇ ਸਪੋਰਟਸ ਵੀ ਕਰਵਾਉਂਦੇ ਆ ਕਲਚਰ ਐਕਟੀਵਿਟੀ ਵੀ ਕਰਵਾਉਂਦੇ ਆ ਇਸ ਤੋਂ ਇਲਾਵਾ ਇੱਥੇ ਸਵੀਵਿੰਗ ਪੂਲ ਵੀ ਹੈਗਾ ਆ ਔਰ ਬੱਚਿਆਂ ਨੂੰ ਇਹ ਯੂਰਪ ਟੂਰ ਵੀ ਲੈ ਕੇ ਜਾਂਦੇ ਹੈਗੇ ਔਰ ਬਹੁਤ ਵਧੀਆ ਸਟੱਡੀ ਇੱਥੇ ਕਰਵਾਈ ਜਾਂਦੀ ਆ ਮੈਂ ਇਹ ਤਾਂ ਤੁਹਾਨੂੰ ਸਪੈਸ਼ਲੀ ਪ੍ਰੈਫਰ ਕੇ ਸੀ ਪਬਲਿਕ ਸਕੂਲ ਹੀ ਕਹਾਂਗੀ ਇਸ ਤੋਂ ਇਲਾਵਾ ਜਿਹੜੇ ਆਹ ਕੈਮਬ੍ਰੇਜ ਸਕੂਲ ਹੈਗਾ ਆ ਜਾਂ ਫਿਰ ਆਪਣੇ ਸੈਂਟ ਜੌਸਫ ਸਕੂਲ ਹੈਗਾ ਆ ਉਹ ਵੀ ਕਾਫੀ ਅੱਛਾ ਹੈ ਔਰ ਬਟ ਉਹ ਉਨ ਉਹ ਤੁਹਾਡੇ ਸਾਡੇ ਕੋਲ ਨਵਾਂਸ਼ਹਿਰ ਤੋਂ ਬਾਹਰ ਪੈ ਜਾਂਦਾ ਹੈ ਜਿੱਦਾਂ ਕੈਮਬ੍ਰੇਜ਼ ਵੀ ਸਾਡੇ ਕੋਲ ਕਰਿਆਮ ਰੋਡ 'ਤੇ ਪੈ ਜਾਂਦਾ ਅਤੇ ਸੈਂਟ ਜੋਸਫ ਸਾਡੇ ਕੋਲ ਰੋਡ 'ਤੇ ਪੈ ਜਾਂਦਾ ਹੈ ਅਤੇ ਕੇ ਸੀ ਪਬਲਿਕ ਨਵਾਂਸ਼ਹਿਰ ਜੋ ਹੈਗਾ ਆ ਉਹ ਸਾਡੇ ਨਵਾਂਸ਼ਹਿਰ ਦੇ ਵਿੱਚ ਆਉਂਦਾ ਹੈਗਾ ਆ ਹਾਂਜੀ ਬਸ ਫੈਸਿਲਿਟੀ ਹੈ ਔਰ ਜੇ ਕੋਈ ਕੁਏਰੀ ਵਗੈਰਾ ਹੁੰਦੀ ਹੈ ਤਾਂ ਟਵੈਂਟੀ ਫੋਰ ਆਵਰ ਪ੍ਰਿੰਸੀਪਲ ਅਵੇਲੇਬਲ ਹੁੰਦੀ ਆ ਜਿਸ ਵੇਲੇ ਜੇ ਮਰਜ਼ੀ ਤੁਸੀਂ ਟਾ ਸਕੂਲ ਟਾਈਮ ਦੇ ਵਿੱਚ ਬੜੇ ਆਰਾਮ ਦੇ ਨਾਲ ਪੁੱਛ ਸਕਦੇ ਹੋ ਔਰ ਟੀਚਰਸ ਵੀ ਬੜੀ ਫਰੈਂਡਲੀ ਔਰ ਬਹੁਤ ਅੱਛੇ ਆ ਕਿ ਤੁਹਾਨੂੰ ਕਦੇ ਬੱਚੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਥੈਂਕ ਯੂ ਸੋ ਮੱਚ ਮੈਮ ਓਕੇ ਮੈਮ